ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਸੀਮੈਂਟ ਲੈਣਾ ਤੁਹਾਡੇ ਤੋਂ ਕਿਹੜੀ ਕਿਹੜੀ ਕਿਸਮ ਦਾ ਸੀਮੈਂਟ ਹੈ ਸਾਨੂੰ ਗਾਈਡ ਕਰੋ ਜੀ

ਮਕਾਨ ਬਣਾਉਣਾ ਜੀ ਸੌ ਗਜ਼ ਦਾ ਮਕਾਨ ਹੈ ਜੀ ਕੂਏਂਟਲਾਂ 'ਚ ਸੀਮੈਂਟ ਚਾਹੀਦਾ ਜੀ ਸਾਨੂੰ

ਹਾਂਜੀ ਸੌ ਬੋਰੀ ਹਾਂਜੀ ਉਹ ਸੌ ਬੋਰੀ ਅਤੇ ਕੁਝ ਡਿਸਕਾਊਂਟ ਮਿਲ ਸਕਦਾ ਜੀ ਅੰਬੂਜਾ ਜੀ

ਜੀ ਕਿੰਨੇ ਦਿਨਾਂ ਤੱਕ ਸਾਨੂੰ ਤੁਸੀਂ ਡਿਲੀਵਰੀ ਕਰ ਸਕਦੇ ਹੋ

ਠੀਕ ਹੈ ਜੀ ਠੀਕ ਹੈ ਜੀ ਪੈਸੇ ਵੀ ਤੁਹਾਡੇ ਅਕਾਊਂਟ ਦੇ ਵਿੱਚ ਟਰਾਂਸਫਰ ਕਰਵਾ ਦਵਾਂਗੇ

ਵੈਸੇ ਇੱਕ ਬੋਰੀ ਦਾ ਰੇਟ ਦੱਸ ਸਕਦੇ ਹੋ ਤੁਸੀਂ ਸਾਨੂੰ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜਿਸ ਦਿਨ ਤੁਸੀਂ ਸਾਨੂੰ ਡਿਲੀਵਰੀ ਕਰ ਦਉਗੇ ਅਸੀਂ ਉਸ ਦਿਨ ਹੀ ਆਪਣਾ ਛੇਤੀ ਛੇਤੀ ਕੰਮ ਆਰੰਭ ਕਰ ਸਕੀਏ ਹਾਂਜੀ ਹਾਂਜੀ ਮਿਲਾਟਵ 'ਚ ਨਾ ਹੋਵੇ ਬਹੁਤ ਸੀਮਿੰਟ ਰਲਾਵਟ 'ਚ ਆ ਰਹੇ ਨੇ ਅਤੇ ਮਗਰੋਂ ਬਾਅਦ ਦੇ ਵਿੱਚ ਮਕਾਨ 'ਤੇ ਕਲ਼ਰ ਜੇ ਸਾਨੂੰ ਮਤਲਵ ਤੁਹਾਡਾ ਸੀਮੈਂਟ ਵਧੀਆ ਲੱਗਿਆ ਤਾਂ ਫਿਰ ਸਾਡੇ ਰਿਸ਼ਤੇਦਾਰ ਵੀ ਮਕਾਨ ਬਣਾ ਰਹੇ ਨੇ ਅਸੀਂ ਉਹਨਾਂ ਤੋਂ ਵੀ ਤੁਹਾਡਾ ਸੀਮੈਂਟ ਹੋਰ ਸੇਲ ਵੱਧ ਕਰਵਾਵਾਂਗੇ

ਹਾਂਜੀ

ਹਾਂਜੀ ਹਾਂਜੀ ਹਾਂਜੀ

ਠੀਕ ਹੈ ਜੀ ਹਫ਼ਤੇ ਤੱਕ ਤੁਸੀਂ ਭੇਜ ਦਓ ਠੀਕ ਹੈ ਜੀ ਧੰਨਵਾਦ ਜੀ